ਹੈਲੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੰਚਨ ਹੈ ਔਰ ਮੈਂ ਆਪ ਜੀ ਨਾਲ ਮੇਰੀ ਔਨਲਾਈਨ ਸ਼ੋਪਿੰਗ 'ਤੇ ਕੁਝ ਰਿਵਿਊ ਸਾਂਝਾ ਕਰਨਾ ਚਾਹੁੰਦੀ ਹਾਂ ਪਿਛਲੇ ਹਫਤੇ ਮੈਂ ਇੱਕ ਔਨਲਾਈਨ ਸ਼ੋਪਿੰਗ ਕੀਤੀ ਸੀ ਜਿਸ ਵਿੱਚ ਮੈਂ ਗਰੂਮਿੰਗ ਪ੍ਰੋਡਕਟਸ ਪਰਫਿਊਮ ਮੰਗਵਾਏ ਸੀ ਮੇਰਾ ਕਾਫ਼ੀ ਅੱਛਾ ਐਕਸਪੀਰੀਅੰਸ ਰਿਹਾ ਔਨਲਾਈਨ ਸ਼ੋਪਿੰਗ ਦਾ ਔਰ ਮੈਂ ਆਪਣੇ ਫਰੈਂਡਸ ਨੂੰ ਹਮੇਸ਼ਾ ਸੁਜੈਸਟ ਕਰਾਂਗੀ ਕਿ ਉਹ ਔਨਲਾਈਨ ਹੀ ਅ ਪਰਫਿਊਮਸ ਬਾਏ ਕਰਨ ਇਹ ਪਰਫਿਊਮ ਕਾਫ਼ੀ ਅੱਛੇ ਨੇ ਇਹਨਾਂ ਦਾ ਕਲੈਕਸ਼ਨ ਬਹੁਤ ਅੱਛਾ ਹੈ ਔਰ ਇਹਨਾਂ ਦੀ ਫ੍ਰੈਗਨੈਂਸ ਬਹੁਤ ਅੱਛੀ ਹੈ ਕਾਫ਼ੀ ਮਾਇਲਡ ਫ੍ਰੈਗਨੈਂਸ ਹੈ ਔਰ ਕਾਫੀ ਲੋਂਗ ਲਾਸਟਿੰਗ ਪਰਫਿਊਮ ਨੇ ਸੋ ਮੈਂ ਥੈਂਕ ਯੂ ਕਰਦੀ ਹਾਂ ਔਰ ਮੈਂ ਆਪਣੇ ਫਰੈਂਡਸ ਨੂੰ ਵੀ ਸੁਜੈਸਟ ਕਰਦੀ ਹਾਂ ਕਿ ਉਹ ਔਨਲਾਈਨ ਹੀ ਇਹਨਾਂ ਪਰਫਿਊਮਸ ਨੂੰ ਬਾਏ ਕਰਨ ਕਿਉਂਕਿ ਕਾਫ਼ੀ ਅੱਛੇ ਕਲੈਕਸ਼ਨ ਵਾਲੇ ਪਰਫਿਓਮਸ ਤਾਂ ਮੈਨੂੰ ਮਿਲੇ ਨੇ ਔਰ ਮੇਰਾ ਐਕਸਪੀਰੀਅੰਸ ਕਾਫ਼ੀ ਅੱਛਾ ਰਿਹਾ